ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਮੌਸਮ ਅੱਜ ਕੱਲ੍ਹ ਝੋਨੇ ਦੀ ਚਾਵਲ ਦੀ ਕਟਾਈ ਹੋਣ ਕਾਰਨ ਕਾਫ਼ੀ ਲੋਕ ਅੱਗ ਵਗੈਰਾ ਲਗਾ ਰਹੇ ਆ ਉਹਦੇ ਨਾਲ਼ ਬੱਚਿਆਂ ਦੇ ਸਿਆਣਿਆ ਦੇ ਬਜ਼ੁਰਗਾਂ ਦੇ ਸਾਹ ਲੈਣ ਦੇ ਵਿੱਚ ਬੜੀ ਦਿੱਕਤ ਆ ਰਹੀ ਆ ਇਸ ਕਰਕੇ ਇਸ 'ਤੇ ਜਲਵਾਯੂ ਨੂੰ ਇਹਨੂੰ ਰੋਕਣੇ ਲਈ ਉਪਾਅ ਕਰਨੇ ਚਾਹੀਦੇ ਹਨ ਇਹ ਜੋ ਬਰਸਾਤ ਦਾ ਮੌਸਮ ਹੁੰਦਾ ਹੈ ਉਹਦੇ ਵਿੱਚ ਵੀ ਕਾਫ਼ੀ ਗਰਮੀ ਦੇ ਨਾਲ਼ ਪਸੀਨਾ ਆਉਣ ਕਰਕੇ ਮੌਸਮ ਬਦਲਨ ਕਰਕੇ ਹੁਣ ਗਰਮੀ ਲੰਘ ਰਹੀ ਹੈ ਪਹਿਲਾਂ ਅੱਧੇ ਆਪਾਂ ਸਰੀਰ 'ਤੇ ਕੱਪੜੇ ਪਾਉਂਦੇ ਹੁਣ ਗਾਹਾਂ ਸਿਆਲ ਆਉਣ ਕਰਕੇ ਪੂਰੀ ਬਾਂਹ ਦੇ ਕੋਟੀ ਸਵੈਟਰ ਪਾਉਣ ਦੇ ਲਈ ਆਪਾਂ ਨੂੰ ਮੌਸਮ ਦੇ ਬਦਲਾਓ ਅਨੁਸਾਰ ਬਦਲਨਾ ਚਾਹੀਦਾ ਹੈ